ਪੀ ਟੀ ਊਸ਼ਾ ਨਾਮ ਨਾਲ ਇੱਕ ਮਸ਼ਹੂਰ ਪੀ ਟੀ ਊਸ਼ਾ ਬਹੁਤ ਹੀ ਵਧੀਆ ਖਿਡਾਰਨ ਹੈ ਅਤੇ ਉਸ ਨੂੰ ਅੰਤਰਰਾਸ਼ਟਰੀ ਖੇਡਾਂ ਵਿੱਚ ਬਹੁਤ ਹੀ ਮਾਡਲ ਹੈ ਜਿਵੇਂ ਇ ਉਸ ਉਹਨਾਂ ਨੇ ਇੱਕ ਸੌ ਇੱਕ ਮਾਡਲ ਜਿੱਤੇ ਹਨ ਅਤੇ ਉਸਦੇ ਨਾਲ ਨਾਲ ਉਸ ਨੂੰ ਅੰਤਰਰਾਸ਼ਟਰੀ ਖੇਡਾਂ ਵਿੱਚ ਉਸਨੂੰ ਉੱਡਣਪਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਸੌ ਦੋ ਸੌ ਕਿਲੋਮੀਟਰ ਦੀ ਐਥਲੈਟਿਕ ਰੇਸ ਮੀਟਰ ਨਾਲ ਉਸ ਨੂੰ ਵਧੀਆ ਜਾਣਿਆ ਜਾਂਦਾ ਹੈ ਅਤੇ ਉਹ ਵਧੀਆ ਵੂਮੈਨ ਹੈ ਤਾਂ ਜੋ ਉਸਦਾ ਜਨਮ ਸਤਾਈ ਜੁਲਾਈ ਉੱਨੀ ਸੌ ਸੰਤਾਲੀ ਨੂੰ ਕੇਰਲ ਵਿਖੇ ਹੋਇਆ ਹੈ ਅਤੇ ਉਸ ਨੂੰ ਉਸ ਨੂੰ ਵਧੀਆ ਖਿਡਾਰਨ ਜਾਣਿਆ ਜਾਂਦਾ ਹੈ ਅਤੇ ਉਹ ਇੱਕ ਬਹੁਤ ਹੀ ਬਹੁਤ ਹੀ ਵਧੀਆ ਵੂਮੈਨ ਹੈ ਤਾਂ ਜੋ ਕਿ ਸਾਨੂੰ ਉਸ ਤੋਂ ਉਸ ਨੂੰ ਵੂਮੈਨ ਤੋਂ ਸਪੋਰਟਸ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਉਹ ਉਸਨੇ ਅੰਤਰਰਾਸ਼ਟਰੀ ਖੇਡਾਂ ਵਿੱਚੋਂ ਇੱਕ ਸੌ ਇੱਕ ਮੈਡਲ ਹਾਸਿਲ ਕੀਤੇ ਤਾਂ ਜੋ ਕਿ ਉਸਨੂੰ ਉੱਡਣਪਰੀ ਕਿਹਾ ਜਾਂਦਾ ਹੈ ਔਰ ਬਹੁਤ ਹੀ ਵਧੀਆ ਹੈ ਉਹ ਅਤੇ ਅਸੀਂ ਉਸ ਬਾਰੇ ਬਹੁਤ ਕੁਝ ਜਾਣਦੇ ਹਾਂ